ਮੇਰੇ ਖੇਤਰ ਵਿੱਚ ਅੱਜ ਕੱਲ੍ਹ ਦੇ ਦੌਰ ਵਿੱਚ ਜਿਹੜਾ ਚੱਲਦਾ ਹੈ ਫੋਨ ਉਹ ਹੈ ਆਈਫੋਨ ਲੋਕ ਸਭ ਤੋਂ ਵੱਧ ਇਸ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਤੋਂ ਵਧੀਆ ਫੋਨ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਹੈ ਹੀ ਨਹੀਂ ਬਟ ਪਰ ਜੇ ਅਸੀਂ ਦੇਖੀਏ ਤਾਂ ਇਸ ਤੋਂ ਕਈ ਬਿਹਤਰ ਫੋਨ ਹੁਣ ਕੰਪਨੀਆਂ ਕੱਢ ਚੁੱਕੀਆਂ ਹਨ ਜਿਵੇਂ ਕਿ ਸੈਮਸੰਗ ਦੇ ਸੈਮਸੰਗ ਦੇ ਫੋਨ ਬਹੁਤ ਵਧੀਆ ਹਨ ਅਤੇ ਕਈ ਲੋਕ ਇਸ ਤੋਂ ਉੱਤੇ ਕਿਸ ਹੋਰ ਚੀਜ਼ ਮੰਨਦੇ ਨਹੀਂ ਬਟ ਸਭ ਤੋਂ ਵੱਧ ਪਰ ਜੇ ਆਪਾਂ ਸਭ ਤੋਂ ਵੱਧ ਦੇਖੀਏ ਕਿ ਲੋਕ ਕਿਸ ਚੀਜ਼ ਨੂੰ ਪ੍ਰੈਫਰ ਕ ਤਰਜੀਹ ਦਿੰਦੇ ਹਨ ਉਹ ਹੈ ਆਈਫੋਨ ਕਿਉਂਕਿ ਆਈਫੋਨ ਅੱਜ ਦੇ ਜਮਾਨੇ ਵਿੱਚ ਇੱਕ ਸਮਾਜਿਕ ਜੇ ਤੁਸੀਂ ਉੱਚਾ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਈਫੋਨ ਹੋਣਾ ਜ਼ਰੂਰੀ ਹੈ ਲੋਕਾਂ ਨੂੰ ਇੱਦਾਂ ਲੱਗਦਾ ਅਤੇ ਮੇਰੇ ਕੋਲ ਖੁਦ ਕੋਲ ਵੀ ਵੈਸੇ ਤਾਂ ਆਈਫੋਨ ਹੀ ਹੈ ਬਟ ਪਰ ਮੈਂ ਚਾਹੁੰਦਾ ਹਾਂ ਕਿ ਇਸ ਦੇ ਵਿੱਚ ਐਸ ਜਿਹਾ ਕੁਛ ਵੀ ਨਹੀਂ ਹੈ ਵੀ ਹੈ ਨਾ ਵੀ ਜੋ ਇਸਨੂੰ ਖ਼ਾਸ ਬਣਾਉਂਦਾ ਹੈ ਖ਼ਾਸ ਤਾਂ ਫੋਨ ਦੇ ਫੋਨ ਦੀ ਲੋੜ ਮੁਤਾਬਿਕ ਹੁੰਦਾ ਹੈ ਅਤੇ ਜੇ ਤੁਹਾਨੂੰ ਆਈਫੋਨ ਦੀ ਲੋੜ ਨਹੀਂ ਹੈ ਤਾਂ ਉਹਦਾ ਤੁਸੀਂ ਕੁਛ ਨਹੀਂ ਕਰ ਸਕਦੇ ਪਰ ਇਹ ਹੀ ਜੇ ਤੁਹਾਨੂੰ ਸੈਮਸੰਗ ਦੀ ਲੋੜ ਹੈ ਤਾਂ ਤੁਸੀਂ ਆਈਫੋਨ ਲੈ ਕੇ ਕੁਛ ਨਹੀਂ ਕਰ ਸਕਦੇ ਬਟ ਜੇ ਤੁਸੀਂ ਆਈਫੋਨ ਲੈ ਹੀ ਲਿਆ ਤਾਂ ਹੁਣ ਤੁਸੀਂ ਉਹਦਾ ਫਿਰ ਨਿਰਾਸ਼ ਹੀ ਹੋਊਗੇ ਉਸ ਉਸ ਨੂੰ ਲੈ ਕੇ ਇਸ ਲਈ ਆਪਣੀ ਲੋੜ ਮੁਤਾਬਿਕ ਫੋਨ ਨੂੰ ਹਮੇਸ਼ਾ ਲੈਣਾ ਚਾਹੀਦਾ ਹੈ ਧੰਨਵਾਦ